ਹੈਲੋ ਊਬਰ ਡਰਾਈਵਰ ਗੁਰਪ੍ਰੀਤ ਸਿੰਘ ਗੱਲ ਕਰ ਰਹੇ ਹੋ ਗੱਡੀ ਨੰਬਰ ਪੀਬੀ ਜ਼ੀਰੋ ਇੱਕ ਬੀਸੀ ਸੱਤ ਨੌਂ ਛੇ ਛੇ ਹਾਂਜੀ ਵੀਰ ਜੀ ਮੈਂ ਨਾ ਤੁਹਾਡੀ ਕੈਬ ਬੁੱਕ ਕਰਵਾਈ ਸੀ ਬਠਿੰਡੇ ਤੋਂ ਮੋਹਾਲੀ ਏਅਰਪੋਰਟ ਤੱਕ ਅਤੇ ਹੁਣ ਮੈਂ ਮੋਹਾਲੀ ਏਅਰਪੋਰਟ 'ਤੇ ਖੜ੍ਹਾ ਪਰ ਮੇਰਾ ਨਾ ਬਟੂਆ ਤੁਹਾਡੀ ਗੱਡੀ ਦੇ ਵਿੱਚ ਰਹਿ ਗਿਆ ਅਤੇ ਮੇਰੀ ਅੱਧੇ ਘੰਟੇ ਦੇ ਵਿੱਚ ਫਲਾਈਟ ਹੈ ਅਤੇ ਮੇਰਾ ਪਾਸਪੋਰਟ ਟਿਕਟ ਆਧਾਰ ਕਾਰਡ ਪੈਨ ਕਾਰਡ ਸਾਰੇ ਜਿਹੜੇ ਡਾਕੂਮੈਂਟ ਤੁਹਾਡੀ ਕੈਬ ਦੇ ਵਿੱਚ ਰਹਿ ਗਏ ਨੇ ਅਤੇ ਤੁਸੀਂ ਜਿੱਥੇ ਵੀ ਹੋ ਵੀਰ ਜੀ ਕਿਰਪਾ ਕਰਕੇ ਮੈਨੂੰ ਮੇਰਾ ਸਮਾਨ ਡਾਕੂਮੈਂਟ ਵਾਪਸ ਕਰ ਦਿਓ ਤੁਹਾਡੀ ਬਹੁਤ ਹੀ ਮਿਹਰਬਾਨੀ ਹੋਵੇਗੀ ਮੇਰੀ ਅੱਧੇ ਘੰਟੇ ਤੱਕ ਫਲਾਈਟ ਆ ਅਤੇ ਜੇ ਮੈਂ ਨਾ ਗਿਆ ਤਾਂ ਮੇਰੇ ਫਲਾਈਟ ਮਿਸ ਹੋ ਜਾਣੀ ਹੈ ਮੇਰਾ ਬਹੁਤ ਜ਼ਰੂਰੀ ਕੰਮ ਹੈ ਬਾਈ ਜੀ ਤੁਸੀਂ ਜਿੱਥੇ ਵੀ ਹੋ ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਮੈਨੂੰ ਮੇਰਾ ਸਮਾਨ ਵਾਪਸ ਕਰ ਦੋਗੇ ਮੈਂ ਏਅਰਪੋਰਟ 'ਤੇ ਖੜ੍ਹਾ ਤੁਹਾਡਾ ਇੰਤਜ਼ਾਰ ਕਰ ਰਿਹਾਂ ਅਤੇ ਜੇ ਤੁਸੀਂ ਮੈਨੂੰ ਫੜਾ ਕੇ ਜਾਓਗੇ ਤਾਂ ਮੈਂ ਤੁਹਾਨੂੰ ਕੋਈ ਬਣਦਾ ਸਰਦਾ ਇਨਾਮ ਜੋ ਵੀ ਹੋਵੇਗਾ ਮੈਂ ਤੁਹਾਨੂੰ ਦਊਂਗਾ ਅਤੇ ਕਿਰਪਾ ਕਰਕੇ ਮੇਰੀ ਗੁਜ਼ਾਰਿਸ਼ ਆ ਕਿ ਤੁਸੀਂ ਜਿੱਥੇ ਵੀ ਹੋ ਮੈਨੂੰ ਮੇਰਾ ਬਟੂਆ ਫੜਾ ਜਾਓ ਇਹ ਮੇਰੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ